ਜ਼ਿੰਦਗੀ ਚਲਦੀ ਦਾ ਨਾਮ ਹੈ ਹਰ ਰੋਜ਼ ਨਵੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਅੱਜ ਕੱਲ੍ਹ ਤਾਂ ਪਤਾ ਨਹੀਂ ਕਿਹੜੇ ਕਿਹੜੇ ਪਕਵਾਨ ਆਉਂਦੇ ਜਾ ਰਹੇ ਨੇ ਬੱਚੇ ਪਤਾ ਨਹੀਂ ਕੀ ਕੁਝ ਖਾਂਦੇ ਨੇ ਸਭ ਤੋਂ ਗੁੰਝਲਦਾਰ ਚੀਜ਼ ਮੈਨੂੰ ਮਕਰੋਨੀ ਓਹੀ ਲੱਗਦੀ ਏ ਨਾਲੇ ਹੈ ਵੀ ਇੰਨੀ ਸੌਖੀ ਪਰ ਉਵੇਂ ਦੀ ਨਹੀਂ ਬਣਦੀ ਜਿਵੇਂ ਦੀ ਬੱਚੇ ਮੰਗਦੇ ਨੇ ਪਹਿਲੇ ਦਿਨੋਂ ਹੀ ਬੱਚੇ ਕਹਿ ਦਿੰਦੇ ਨੇ ਮੰਮਾ ਬਾਜ਼ਾਰ ਵਰਗੀ ਬਨਾਇਓ ਪਰ ਜਦੋਂ ਮੈਂ ਬਨਾਉਂਦੀ ਹਾਂ ਕਹਿੰਦੀ ਤਾਂ ਇਹੀ ਆ ਵੀ ਬਣਾਵਾਂਗੀ ਜ਼ਰੂਰ ਪਰ ਕਦੇ ਨਹੀਂ ਬਣੀ ਪਤਾ ਨਹੀਂ ਉਹ ਅਟਪਟਾ ਜਿਹਾ ਸਵਾਦ ਕਿੱਥੋਂ ਆਉਂਦਾ ਏ ਬਾਜ਼ਾਰ ਵਾਲਿਆਂ ਕੋਲ ਮੇਰੇ ਕੋਲ ਉਹ ਤਾਂ ਕਦੇ ਨਹੀਂ ਬਣਿਆ ਦੂਜੀ ਚੀਜ਼ ਇਹ ਉਹ ਲੱਛੇਦਾਰ ਸੇਵੀਆਂ ਤਰ੍ਹਾਂ ਤਰ੍ਹਾਂ ਦੇ ਸਿਲਾਈਆਂ ਜੀਆਂ ਨਾਲ ਖਾਣੀਆਂ ਪਰ ਉਹ ਮੇਰੇ ਤੋਂ ਕਦੇ ਨਹੀਂ ਬਣੀਆਂ ਮੈਂ ਤਾਂ ਅਸੀਂ ਤਾਂ ਸਿੱਧੇ ਸਾਧੇ ਲੋਕ ਹਾਂ ਸੇਵੀਆਂ ਖਾਣ ਵਾਲੇ ਉਹ ਸੇਵੀਆਂ ਜਿਹੜੀਆਂ ਮਾਵਾਂ ਹੱਥਾਂ ਨਾਲ ਵੱਟਦੀਆਂ ਸੀ ਜਾਂ ਜੰਦਰੀ ਨਾਲ ਵੱਟ ਕੇ ਸਿੱਧਾ ਦੁੱਧ 'ਚ ਪਾ ਦਿੰਦੀਆਂ ਸੀ ਪਤਾ ਨਹੀਂ ਇਹ ਕਿੱਥੋਂ ਬਣਾਉਣੀਆਂ ਨੇ ਅਸੀਂ ਤਾਂ ਨਹੀਂ ਬਣਾ ਸਕਦੇ ਇਹ ਮੈਗੀਜ਼ ਹੈ ਨਿਊਡਲਸ ਔਰ ਉਹਨਾਂ ਦਾ ਸਵਾਦ ਉਹ ਵਾਲਾ ਜੋ ਬਾਜ਼ਾਰ ਚੋਂ ਮਿਲਦਾ ਏ ਬਾਜ਼ਾਰ ਚੋਂ ਬੱਚੇ ਖਾ ਤਾਂ ਲੈਣ ਪਰ ਬਾਜ਼ਾਰ ਵਾਲਾ ਮੈਂ ਖਾਣਾ ਖਵਾਉਣਾ ਨਹੀਂ ਅਤੇ ਘਰੇ ਉਹਨਾਂ ਨੇ ਖਾਣਾ ਨਹੀਂ ਇਸੇ ਲਈ ਮੈਂ ਚਾਹੁੰਦੀ ਹਾਂ ਕਿ ਮੈਂ ਨਵੀਆਂ ਨਵੀਆਂ ਚੀਜ਼ਾਂ ਟਰਾਈ ਕਰਾਂ ਅਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਜ਼ਰੂਰ ਬਣਾਉਣਾ ਸਿੱਖਾਂ